ਨਮਸਤੇ ਜੀ ਹਾਂਜੀ ਪਹਿਲਾਂ ਤੁਸੀਂ ਜਦੋਂ ਇੰਡੀਆ ਆਉਣਾ ਅਤੇ ਨੀਅਰੈਸਟ ਏਅਰਪੋਰਟ ਹੈਗਾ ਇੱਥੇ ਅੰਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਉੱਥੇ ਤੁਸੀਂ ਉੱਤਰ ਕੇ ਠੀਕ ਹੈ ਜਿਲ੍ਹਾ ਹੁਸ਼ਿਆਰਪੁਰ 'ਚ ਤੁਸੀਂ ਆ ਸਕਦੇ ਹੋ ਅਤੇ ਬਥੇਰੀਆਂ ਇੱਥੇ ਉਹ ਆ ਟੂਰਿਸਟ ਪਲੇਸਿਸ ਜਿੱਥੇ ਘੁੰਮ ਸਕਦੇ ਹਾਂ ਅਤੇ ਵੈਸੇ ਤਾਂ ਆਦਮਪੁਰ ਏਅਰਪੋਰਟ ਵੀ ਹੈ ਪਰ ਉਹ ਇੰਟਰਨੈਸ਼ਨਲ ਨਹੀਂ ਹੈ ਹਜੇ ਅਤੇ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਆ ਧਰਮ ਜੀ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਰਾਮਦਾਸ ਹੈ ਅੰਬਰਸਰ ਆ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਉੱਥੋਂ ਤੁਹਾਨੂੰ ਟੈਕਸੀਆਂ ਬਥੇਰੀਆਂ ਮਿਲ ਜਾਣੀਆਂ ਟੈਕਸੀ ਦੇ ਥਰੂ ਤੁਸੀਂ ਹੁਸ਼ਿਆਰਪੁਰ ਵਿੱਚ ਆ ਸਕਦੇ ਹੈ ਮੇਰੇ ਹਿਸਾਬ ਨਾਲ ਤਿੰਨ ਕੁ ਦੋ ਤਿੰਨ ਘੰਟੇ ਦਾ ਰਸਤਾ ਅਤੇ ਜੇ ਟੂਰਿਸਟਿਸ ਪਲੇਸਿਸ ਦੀ ਗੱਲ ਕਰੀਏ ਹੁਸ਼ਿਆਰਪੁਰ ਦੇ ਵਿੱਚ ਇੱਥੇ ਹੈਗੇ ਆਪਣੇ

ਚੋਹਾਲ ਡੈਮ ਹੈਗਾ ਅਤੇ ਢੋਲਬਾਹਾ ਡੈਮ ਜਨੋਲੀ ਡੈਮ ਅਤੇ ਦੂਸਰਾ ਹੈਗਾ ਇੱਕ ਹੈਗਾ ਫੁਜਵਾੜਾ ਫੋਟ ਅਤੇ ਕੂਕਾ ਨੇਟ ਦੇ ਜੰਗਲ ਹੈ ਮਸ਼ਹੂਰ ਹੈ ਜਿੱਥੇ ਜੰਗਲ ਸਫਾਰੀ ਵੀ ਤੁਸੀਂ ਕਰ ਸਕਦੇ ਹੋ ਟੈਕਸੀ ਸਹੀ ਰਹੇਗੀ ਟੈਕਸੀ 'ਚ ਵੈਸੇ ਬੱਸ ਬੱਸਾਂ ਬੱਸਾਂ ਵੀ ਆਉਂਦੀਆਂ ਹਾਂ ਉਹ ਤੁਹਾਨੂੰ ਫਿਰ ਜਾਣਾ ਪੈਣਾ ਵਾ ਸ਼੍ਰੀ ਫਿਰ ਤੁਸੀਂ ਇੰਟਰਨੈਸ਼ਨਲ ਏਅਰਪੋਰਟ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ ਤੋਂ ਤੁਸੀਂ ਰਿਕਸ਼ਾ ਕਰੋ ਅਤੇ ਬੱਸ ਸਟੈਂਡ ਅੰਬਰਸਰ ਬੱਸ ਸਟੈਂਡ ਉੱਥੋਂ ਤੁਹਾਨੂੰ ਹੁਸ਼ਿਆਰਪੁਰ ਦੀਆਂ ਬੱਸਾਂ ਮਿਲ ਜਾਣੀਆਂ ਹੁਸ਼ਿਆਰਪੁਰ ਤੋਂ ਇੱਥੋਂ ਤੁਸੀਂ ਅੰਬਰਸਰ ਤੋਂ ਬਾਇਪਾਸ ਹੁਸ਼ਿਆਰਪੁਰ ਆ ਸਕਦੇ ਹਾਂ ਅਤੇ ਉੱਥੋਂ ਹੁਸ਼ਿਆਪੁਰ ਤੋਂ ਤੁਸੀਂ ਜਾਂ ਟੈਕਸੀ 'ਚ ਜੇ ਵਿਜਿਟ ਕਰਨਾ ਤਾਂ ਟੈਕਸੀ ਸਹੀ ਰਹੂਗੀ ਉੱਥੋਂ ਉੱਥੋਂ ਤੁਸੀ ਅੰਬਰਸਰੋਂ ਉੱਤੇ ਆ ਸਕਦੇ ਹਾਂ ਅਤੇ ਉੱਥੋਂ ਅੰਬਰਸਰੋਂ ਜੇ ਬੱਸ 'ਚ ਆ ਸਕਦੇ ਹਾਂ ਅਤੇ ਹੁਸ਼ਿਆਰਪੁਰੋਂ ਤੁਹਾਨੂੰ ਟੈਕਸੀ ਸਹੀ ਰਹੂਗੀ ਕਿਉਂਕਿ ਅੱਗੇ ਤੁਸੀਂ ਹੋਰ ਪਲੇਸਸ 'ਤੇ ਜਾਣਾ ਨਾ ਟੂਰਿਸਟ ਪਲੇਸਸ 'ਤੇ ਜਾਣਾ ਤਾਂ ਉਹ ਟੈਕਸੀ ਸਹੀ ਰਹੇਗੀ ਕਿਉਂਕਿ ਹਰੇਕ ਜਗ੍ਹਾ ਬੱਸ ਤਾਂ ਜਾਂਦੀ ਨਹੀਂ ਨਾ

ਹੁਸ਼ਿਆਰਪੁਰ ਦੇ ਵਿੱਚ ਇੱਕ ਤਾਂ ਚੋਹਾਲ ਡੈਮ ਅਤੇ ਉਹਦੇ ਨਾਲ ਹੀ ਇੱਕ ਲੇਕ ਬਣੀ ਆ ਲੇਕ ਦਾ ਨਾਮ ਮੈਨੂੰ ਭੁੱਲ ਗਿਆ ਵਿਕਰਾਂਤ ਲੇਕ ਇੱਦਾਂ ਹੀ ਕੁੱਛ ਆ ਨੇਚਰਸ ਪਾਰਕ ਹੈਗੀ ਆ ਨੇਚਰਸ ਪਾਰਕ ਹੈਗੀ ਆ ਚੋਹਾਲ ਡੈਮ ਦੇ ਨਾਲ ਹੀ

ਹਾਂ ਰੈਸਟੋਰੈਂਟ ਵੀ ਉੱਥੇ ਬਣਿਆ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਤੁਸੀਂ ਮੈਨੂੰ ਕੋਲ ਕਰ ਲਿਓ ਜੀ ਜਦੋਂ ਵੀ ਆਉਣਾ ਹੋਊਗਾ ਓਕੇ ਓਕੇ